ਮੈਂ ਹਾਲੇ ਵੀ ਜਦੋਂ ਕੋਈ ਪੋਸਟ ਆਫਿਸ ਜਾਂ ਸਰਕਾਰੀ ਦਫਤਰ ਜਾਂਦਾ ਹਾਂ ਉੱਥੇ ਨਕਦ ਭੁਗਤਾਨ ਕਰਤਾ ਹਾਂ ਪਰੰਤੂ ਇੰਟਰਨੈਟ 'ਤੇ ਲੈਣ ਦੇਣ ਅਤੇ ਪੈਸੇ ਦੇ ਸੰਕਲਪ ਨੂੰ ਕਾਫੀ ਵਧੀਆ ਤਰੀਕੇ ਨਾਲ ਬਦਲਿਆ ਹੈ ਜਿੱਥੇ ਕਿ ਹੁਣ ਕਿਸੇ ਵੀ ਦੁਕਾਨ 'ਤੇ ਪੈਸੇ ਦੇਣੇ ਅਤੇ ਪੈਸੇ ਦਾ ਅਦਾਨ ਪ੍ਰਦਾਨ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ